ਮੇਰੇ ਪਿੰਡ ਦੇ ਨਾਲ ਹੀ ਰੋਪੜ ਬਜ਼ਾਰ ਪੈਂਦਾ ਹੈ ਜੋ ਇੱਕ ਬਹੁਤ ਹੀ ਜ਼ਿਆਦਾ ਵੱਡਾ ਬਜ਼ਾਰ ਹੈ ਰੋਪੜ ਸ਼ਹਿਰ ਵਿੱਚ ਅਤੇ ਇੱਥੇ ਹਰ ਚੀਜ਼ ਉੁਪਲਬਧ ਹੈ ਇੱਥੇ ਇੱਥੇ ਇਲੈਕਟ੍ਰਿਕ ਚੀਜ਼ਾਂ ਦੇ ਨਾਲ ਨਾਲ ਸਬਜ਼ੀਆਂ ਤੋਂ ਲੈ ਕੇ ਸਕੂਲ ਦਾ ਹਰ ਇੱਕ ਸਮਾਨ ਮਿਲਦਾ ਹੈ ਇੱਥੇ ਕੱਪੜਿਆਂ ਦੀ ਬਹੁਤ ਜ਼ਿਆਦਾ ਦੁਕਾਨਾਂ ਹਨ ਇੱਥੇ ਆਪਾਂ ਹਰ ਤਰ੍ਹਾਂ ਦੇ ਕੱਪੜੇ ਖਰੀਦ ਸਕਦੇ ਹਨ ਐਥੇ ਸਬਜ਼ੀਆਂ ਅਤੇ ਕਰਿਆਨਿਆਂ ਦੀ ਵੀ ਬਹੁਤ ਹੀ ਜ਼ਿਆਦਾ ਵੱਡੀਆਂ ਦਕਾਨਾਂ ਹਨ ਜਿੱਥੇ ਬਹੁਤ ਹੀ ਵਧੀਆ ਰੇਟ ਉੱਤੇ ਸਬਜ਼ੀ ਅਤੇ ਕਰਿਆਨਾ ਮਿਲ ਜਾਂਦਾ ਹੈ ਅਤੇ ਮੈਂ ਓਨਲਾਈਨ ਖਰੀਦ ਖਰੀਦਦਾਰੀ ਬਾਰੇ ਸੋਚਦਾ ਹਾਂ ਕਿ ਇਹ ਮੈ ਮੈਨੂੰ ਠੀਕ ਨਹੀਂ ਲੱਗੀ ਇੱਕ ਵਾਰੀ ਮੈਂ ਓਨਲਾਈਨ ਓਡਰ ਕੀਤਾ ਸੀ ਅਤੇ ਓ ਜਿਸ ਤਰ੍ਹਾਂ ਉਹ ਦਿਖਾਇਆ ਹੋਇਆ ਸੀ ਉਸ ਤਰ੍ਹਾਂ ਦੀ ਚੀਜ਼ ਮੇਰੇ ਕੋਲ ਨਹੀਂ ਆਈ ਇਸ ਕਰਕੇ ਮੈਂ ਉਸ ਦੀ ਬਹੁਤ ਨਿੰਦਿਆ ਕਰਦਾ ਹਾਂ ਅਤੇ ਉਹ ਮੈਨੂੰ ਪਸੰਦ ਨਹੀਂ ਅਤੇ ਮੈਂ ਆਪ ਆਪ ਅੱਖੀ ਦੇਖੀ ਚੀਜ਼ ਲੈਣਾ ਜ਼ਿਆਦਾ ਪਸੰਦ ਕਰਾਂਗਾ